ਮੇਰਾ ਪਸੰਦੀਦਾ ਖੇਡ ਕ੍ਰਿਕਟ ਹੈ ਅਤੇ ਖਿਡਾਰੀ ਮਹਿੰਦਰ ਸਿੰਘ ਧੋਨੀ ਹੈ ਉਹਨਾਂ ਦੀ ਪਰਸਨੈਲਿਟੀ ਮੈਨੂੰ ਬਹੁਤ ਪਸੰਦ ਹੈ ਅਤੇ ਮੈਂ ਜਿਸ ਦਿਨ ਉਹਨਾਂ ਨੂੰ ਮਿਲਾਂਗਾ ਮੈਂ ਉਹਨਾਂ ਤੋਂ ਇੱਕ ਹੀ ਗੱਲ ਸਿੱਖਣੀ ਹੈ ਕਿ ਉਹ ਆਪਣੇ ਮੁਕੰਮਲ 'ਤੇ ਕਿਸ ਤਰ੍ਹਾਂ ਪੁੱਜੇ